ਯੋਗਾ ਇੱਕ ਸਾਡੇ ਇੰਡੀਆ ਦਾ ਪ੍ਰਾਚੀਨ ਸਿਧਾਂਤ ਹੈ ਯੋਗਾ ਰਾਹੀਂ ਅਸੀਂ ਆਪਣੇ ਸਰੀਰ ਨੂੰ ਤੰਦਰੁਸਤ ਰੱਖਦੇ ਹਾਂ ਯੋਗਾ ਰਾਹੀਂ ਅਸੀਂ ਆਪਣੇ ਜੀਵਨ ਸ਼ੈਲੀ ਵਿੱਚ ਡਿਸਿਪਲਨ ਵੀ ਸਿੱਖ ਲੈਂਦੇ ਹਾਂ ਯੋਗਾ ਦੇ ਕਾਰਨ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਵੀ ਮਿਲ ਜਾਂਦਾ ਹੈ ਯੋਗਾ ਨਾਲ ਸਾਡੀ ਉਮਰ ਵੀ ਵਧਦੀ ਹੈ ਯੋਗਾ ਸਾਡੀ ਜੀਵਨ ਸ਼ੈਲੀ ਵਿੱਚ ਸਾਡੇ ਮਾਇੰਡ ਨੂੰ ਫਰੈਸ਼ ਵੀ ਰੱਖਦਾ ਹੈ ਵੱਖ ਵੱਖ ਤਰ੍ਹਾਂ ਦੇ ਯੋਗਾ ਪ੍ਰਾਚੀਨ ਕਾਲ ਵਿੱਚ ਕੀਤੇ ਜਾਂਦੇ ਸੀ ਸਾਡੇ ਰਿਸ਼ੀ ਮੁਨੀ ਵੀ ਯੋਗਾ ਕ ਯੋਗਾ ਹੀ ਕਰਦੇ ਸਨ ਅਤੇ ਤੰਦਰੁਸਤ ਰਹਿੰਦੇ ਸਨ ਯੋਗਾ ਰਾਹੀਂ ਅਸੀਂ ਆਪਣੇ ਦਿਮਾਗ ਆਪਣੇ ਜੀਵਨ ਸ਼ੈਲੀ ਆਪਣੇ ਮਨ ਨੂੰ ਇਕਾਗਰਤਾ ਕਰ ਸਕਦੇ ਹਾਂ ਯੋਗਾ ਸਾਡੇ ਜੀਵਨਸ਼ੈਲੀ ਵਿੱਚ ਬਹੁਤ ਜ਼ਰੂਰੀ ਹੈ ਯੋਗਾ ਕਰਨ ਨਾਲ ਅਸੀਂ ਸਵੇਰੇ ਸਾਡੀ ਰੂਟੀਨ ਬਣਦੀ ਹੈ ਸਵੇਰੇ ਜਲਦੀ ਉੱਠ ਜਾਦੇ ਹਾਂ ਯੋਗਾ ਦੇ ਯੋਗਾ ਕਰਨ ਦੇ ਬਹੁਤ ਰੂਲ ਅਤੇ ਰੈਗੂਲੇਸ਼ਨ ਨੇ ਯੋਗਾ ਸਵੇਰ ਟਾਈਮ ਕੀਤਾ ਜਾ ਸਕਦਾ ਹੈ ਜਾਂ ਇਵਨਿੰਗ ਟਾਈਮ ਵੀ ਕੀਤਾ ਜਾ ਸਕਦਾ ਹੈ ਯੋਗਾ ਰਾਹੀਂ ਅਸੀਂ ਆਪਣੇ ਆਪਣੇ ਸਰੀਰ ਨੂੰ ਇਸ ਤਰ੍ਹਾਂ ਦਾ ਸਟੈਚੇਵਲ ਜਾਂ ਲਚਕੀਲਾਪਣ ਕਰ ਸਕਦੇ ਹਾਂ ਕਿ ਸਾਡੇ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਨੇ ਕਈ ਤਰ੍ਹਾਂ ਦੀ ਬਿਮਾਰੀਆਂ ਜੋ ਐਲੋਪੈਥਿਕ ਦਵਾਈਆਂ ਨਾਲ ਠੀਕ ਨਹੀਂ ਹੁੰਦੀਆਂ ਉਹ ਅਸੀਂ ਯੋਗਾ ਰਾਹੀਂ ਠੀਕ ਕਰ ਸਕਦੇ ਹਾਂ ਯੋਗਾ ਸਾਡੇ ਸਰੀਰ ਨੂੰ ਤੰਦਰੁਸਤ ਹੀ ਬਣਾਉਂਦਾ ਹੈ